ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਾਲਾ ਜੀ ਪ੍ਰਾਪਰਟੀ ਡੀਲਰ ਤੋਂ ਗੱਲ ਕਰ ਰਹੇ ਹਾਂਜੀ ਠੀਕ ਹੈ ਜੀ ਤੁਸੀਂ ਕਿਰਾਏ 'ਤੇ ਰਹੋਗੇ ਜਾਂ ਆਪਣੀ ਜਗ੍ਹਾ ਲੈਣੀ ਹਾਂ ਫਿਲਹਾਲ ਤਾਂ ਜਿਸ ਤਰ੍ਹਾਂ ਤੁਸੀਂ ਨਵੇਂ ਆਏ ਹੋ ਉਸ ਤਰ੍ਹਾਂ ਤੁਹਾਨੂੰ ਇੱਕ ਵਾਰ ਤਾਂ ਕਿਰਾਏ 'ਤੇ ਜਗ੍ਹਾ ਲੈ ਲੈਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਜਗ੍ਹਾ ਵੀ ਲੈ ਸਕਦੇ ਹੋ ਨਾ ਤਾਂ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਜੋ ਹੈ ਜਿਸ ਤਰ੍ਹਾਂ ਕਿਰਾਏ 'ਤੇ ਰਹਿਣ ਲਈ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿਉਂਕਿ ਦਸ ਹਜ਼ਾਰ ਦੇ ਵਿੱਚ ਵਧੀਆ ਤੁਹਾਨੂੰ ਇੱਕ ਕੋਠੀ ਵਰਗਾ ਮਕਾਨ ਜਿਹੜਾ ਮਿਲ ਜਾਂਦਾ ਮਤਲਬ ਜਿਹੜਾ ਉਹ ਰਿਹਾਇਸ਼ੀ ਏਰੀਆ ਉਸ ਵਿੱਚ ਜੋ ਪਾਣੀ ਦੀ ਸੁਵਿਧਾ ਪਾਣੀ ਵੀ ਅੱਛੀ ਕੁਆਲਿਟੀ ਦਾ ਹੈ ਅਤੇ ਬਾਕੀ ਸੁਵਿਧਾ ਔਰ ਸੁਸਾਇਟੀ ਬਹੁਤ ਅੱਛੀ ਹੈ ਉਹ ਤਾਂ ਇੱਕ ਵਾਰ ਤੁਸੀਂ ਮੈਂ ਕਹੂੰਗਾ ਕਿ ਕਿਰਾਏ 'ਤੇ ਰਹੋ ਮਤਲਵ ਦਸ ਹਜ਼ਾਰ ਦੇ ਵਿੱਚ ਜਿਹੜਾ ਹੈ ਤੁਹਾਨੂੰ ਉਹ ਸਾਰੀ ਕੋਠੀ ਦਾ ਰੈਂਟ ਦੇਣਾ ਪਵੇਗਾ ਉਸ ਤੋਂ ਬਾਅਦ ਜਿਵੇਂ ਜੇ ਤੁਸੀਂ ਆਪਣੀ ਜਗ੍ਹਾ ਲੈਣੀ ਹੈ ਤਾਂ ਬਹੁਤ ਕਾਲੋਨੀਆਂ ਹੈਗੀਆਂ ਜਿਵੇਂ ਸਨ ਸਿਟੀ ਇਨਕਲੇਵ ਹੈ ਹੈਂ ਨਾ ਤਾਂ ਮਿੱਤਲ ਟਾਵਰ ਹੈ ਉੱਥੇ ਵੀ ਨਵੀਂਆਂ ਜੋ ਕਲੋਨੀਆਂ ਬਣੀਆਂ ਉੱਥੇ ਵੀ ਪਲਾਟ ਜੋ ਮਿਲਦੇ ਹੈ ਮਤਲਬ ਸਕੇਰ ਗਜ ਦੇ ਹਿਸਾਬ ਨਾਲ ਮਿਲਦੇ ਕਿ ਸੌ ਕੁ ਸੌ ਗਜ ਦੇ ਹਿਸਾਬ ਨਾਲ ਦੋ ਸੋ ਗਜ ਉਹ ਜਿਸ ਤਰ੍ਹਾਂ ਆਪਣੀ ਮਤਲਬ ਡਿਮਾਂਡ ਹੋਵੇਗੀ ਉਸ ਤਰ੍ਹਾਂ ਆਪਾਂ ਦੇਖ ਲਾਂਗੇ ਜਗ੍ਹਾ ਹਾਂ ਇਹਦੇ ਵਿੱਚ ਵੀ ਹੁੰਦਾ ਕਿ ਜਿਵੇਂ ਤੁਸੀਂ ਗਰਾਊਂਡ ਫਲੋਰ ਲੈਣਾ ਤਾਂ ਉਹਦੇ ਲਈ ਅਲੱਗ ਰੈਂਟ ਹੋਵੇਗਾ ਜੇ ਉੱਪਰਲਾ ਫਲੋਰ ਲੈਣਾ ਤਾਂ ਮੰਨ ਲਓ ਜਿਵੇਂ ਅਲੱਗ ਰੈਂਟ ਹੋਵੇਗਾ ਹੂੰ ਹਾਂ ਜਿਵੇਂ ਮਿੱਤਲ ਟਾਵਰ ਹੈ ਉੱਥੇ ਤੁਹਾਨੂੰ ਮਤਲਬ ਟੂ ਬੀ ਐੱਚ ਕੇ ਵੀ ਮਿਲ ਜਾਣਗੇ ਮਤਲਬ ਟੂ ਬੀ ਐੱਚ ਕੇ ਦਾ ਮਤਲਬ ਹੁੰਦਾ ਦੋ ਬੈਡਰੂਮ ਹੋ ਜਾਣਗੇ ਇੱਕ ਹਾਲ ਹੋ ਜਾਵੇਗਾ ਇੱਕ ਕਿਚਨ ਹੋ ਜਾਵੇਗਾ ਹੈ ਨਾ ਤਾਂ ਉੱਥੇ ਹੀ ਜੋ ਹੈ ਤੁਸੀਂ ਮਤਲਬ ਆਪਣਾ ਮਕਾਨ ਆਪਣਾ ਜੋ ਹੈ ਜਦੋਂ ਲੈ ਸਕਦੇ ਓ ਤਾਂ ਉਹਦੇ ਲਈ ਤੁਹਾਨੂੰ ਨੀਅਰ ਅਬਾਊਟ ਚਾਲੀ ਲੱਖ ਰੁਪਏ ਦੇ ਵਿੱਚ ਉਹ ਤੁਹਾਨੂੰ ਅਵੇਲੇਬਲ ਹੋ ਜਾਵੇਗਾ ਬਾਕੀ ਜਗ੍ਹਾ ਦੀ ਅਵੇਲੇਬਿਲਟੀ ਦੇ ਹਿਸਾਬ ਨਾਲ ਹੈ ਨਾ ਬਾਕੀ ਤੁਸੀਂ ਆ ਜੋ ਕੋਈ ਗੱਲ ਨਹੀਂ ਉਹਨਾਂ ਨੂੰ ਤੁਸੀਂ ਆਪਣੀ ਨਾਲ ਲਿਆਇਓ ਫੈਮਿਲੀ ਮੈਂਬਰ ਨੂੰ ਤਾਂ ਆਪਾਂ ਉਹ ਚੈੱਕ ਕਰ ਲਾਂਗੇ ਜੇ ਤੁਹਾਨੂੰ ਠੀਕ ਲੱਗਿਆ ਤੁਸੀਂ ਲੈ ਲਿਓ ਜੀ ਹਾਂ ਉਹ ਰੈਂਟ 'ਤੇ ਵੀ ਸਹੀ ਆ ਰੈਂਟ ਹਾਂ ਰੈਂਟ 'ਤੇ ਸਹੀ ਹੈ ਸਨ ਸਿਟੀ 'ਚ ਨੇ ਹੈ ਉੱਥੇ ਤੁਹਾਨੂੰ ਮਤਲਬ ਇੱਕ ਰੂਮ ਵੀ ਮਿਲ ਜਾਵੇਗਾ ਰੂਮ ਦੀ ਵੀ ਜੋ ਹੈ ਆਪਣਾ ਰੈਂਟ ਹੋਵੇਗਾ ਉਹ ਵੀ ਨੀਅਰ ਅਬਾਊਟ ਦਸ ਹਜ਼ਾਰ ਦੇ ਕਰੀਬ ਹੋਵੇਗਾ ਜਿੱਥੇ ਉਹ ਮਤਲਵ ਸੋਸਾਇਟੀ ਵੈੱਲ ਜੋ ਐਜੁਕੇਟਡ ਲੋਕ ਨੇ ਉੱਥੇ ਉਹ ਰਹਿੰਦੇ ਆ ਉਹ ਇਨਕਲੇਵ ਜੋ ਸਨ ਸਿਟੀ ਹੈ ਉਹ ਵੀ ਅੱਛਾ ਹਾਂ ਦੱਸੋ ਹੈ ਨਾ ਬਾਕੀ ਕੋਈ ਨਹੀਂ ਫੈਮਲੀ ਮੈਂਬਰ ਨੂੰ ਨਾਲ ਲਿਆਇਓ ਆਪਾਂ ਚੈੱਕ ਕਰਲਾਂਗੇ ਜਗ੍ਹਾ ਓਕੇ ਜੀ ਧੰਨਵਾਦ